ਪੰਜਾਬ ਵਿੱਚ ਕਈ ਮਹੱਤਵਪੂਰਨ ਸਿਹਤ ਸਮੱਸਿਆਵਾਂ ਪ੍ਰਚੱਲਿਤ ਹਨ ਜਿਨ੍ਹਾਂ ਵਿੱਚ ਕੈਂਸਰ ਟੀ ਬੀ ਅਤੇ ਫੈਟੀ ਲੀਵਰ ਦੀ ਬਿਮਾਰੀ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਯੋਗ ਹੈ ਕੈਂਸਰ ਦੀਆਂ ਦਰਾਂ ਚਿੰਤਾਜਨਕ ਤੌਰ 'ਤੇ ਉੱਚੀਆਂ ਹਨ ਵਿਆਪਕ ਤੰਬਾਕੂ ਅਤੇ ਸੁਪਾਰੀ ਦੀ ਵਰਤੋਂ ਕਾਰਨ ਮੂੰਹ ਦੇ ਕੈਂਸਰ ਦੇ ਇੱਕ ਮਹੱਤਵਪੂਰਨ ਪ੍ਰਚਲਣ ਦੇ ਨਾਲ ਨਾਲ ਛਾਤੀ ਅਤੇ ਫੇਫੜਿਆਂ ਦੇ ਕੈਂਸਰ ਦੇ ਵੱਧ ਰਹੇ ਕੇਸਾਂ ਦੇ ਨਾਲ ਅਕਸਰ ਵਾਤਾਵਰਨ ਕਾਰਕਾਂ ਅਤੇ ਜੀਵਨ ਸ਼ੈਲੀ ਦੀਆਂ ਚੋਣਾਂ ਦੁਆਰਾ ਵਧਾਇਆ ਜਾਂਦਾ ਹੈ ਟੀ ਬੀ ਇੱਕ ਨਾਜ਼ੁਕ ਜਨਤਕ ਸਿਹਤ ਚਿੰਤਾ ਬਣੀ ਹੋਈ ਹੈ ਜੋ ਕਿ ਉੱਚ ਆਬਾਦੀ ਦੀ ਘਣਤਾ ਨਾਕਾਫੀ ਸਿਹਤ ਸੰਭਾਲ ਬੁਨਿਆਦੀ ਢਾਂਚੇ ਅਤੇ ਅਧੂਰੇ ਜਾਂ ਅਣਨਿਯਮਿਤ ਇਲਾਜ ਨਾਲ ਸੰਬੰਧਿਤ ਚੁਣੌਤੀਆਂ ਜੋ ਕਿ ਡਰੱਗ ਰੋਧਕ ਟੀ ਬੀ ਤਣਾਅ ਦੇ ਫੈਲਣ ਵਿੱਚ ਯੋਗਦਾਨ ਪਾਉਂਦੀਆਂ ਹਨ ਫੈਟੀ ਲੀਵਰ ਦੀ ਬਿਮਾਰੀ ਗੈਰ ਅਲਕੋਹਲਕ ਫੈਟੀ ਲੀਵਰ ਡਿਸੀਜ ਸਮੇਤ ਮੋਟਾਪੇ ਦੀਆਂ ਵੱਧਦੀਆਂ ਦਰਾਂ ਮਾੜੀਆਂ ਖੁਰਾਕਾਂ ਦੀਆਂ ਆਦਤਾਂ ਅਤੇ ਬੈਠਣ ਵਾਲੀ ਜੀਵਨ ਸ਼ੈਲੀ ਦੇ ਕਾਰਨ ਤੇਜ਼ੀ ਨਾਲ ਵੱਧ ਰਹੀ ਹੈ ਜੋ ਕਿ ਪਾਚਕ ਵਿਕਾਰ ਜਿਹੇ ਵਿਆਪਕ ਰਝਾਨਾਂ ਨੂੰ ਦਰਸਾਉਂਦੀ ਹੈ ਇਹ ਸਿਹਤ ਮੁੱਦੇ ਰੋਕਥਾਮ ਛੇਤੀ ਪਤਾ ਲਗਾਉਣ ਅਤੇ ਪ੍ਰਬੰਧਨ 'ਤੇ ਕੇਂਦਰਿਤ ਵਿਆਪਕ ਜਨਤਕ ਸਿਹਤ ਰਣਨੀਤੀਆਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹਨ ਇਹਨਾਂ ਚੁਣੌਤੀਆਂ ਨੂੰ ਸੰਬੋਧਿਤ ਕਰਨ ਲਈ ਜਨਸੰਖਿਆ ਦੇ ਪ੍ਰਭਾਵ ਨੂੰ ਘਟਾਉਣ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਸੰਭਾਲ ਪਹੁੰਚ ਨੂੰ ਬਿਹਤਰ ਬਣਾਉਣ ਜੀਵਨ ਸ਼ੈਲੀ ਦੇ ਵਿਆ ਵਿਕਲਪਾਂ ਅਤੇ ਸਿੱਖਿਆ ਨੂੰ ਵਧਾਉਣ ਅਤੇ ਰੋਗ ਨਿਗਰਾਨੀ ਅਤੇ ਇਲਾਜ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਠੋਸ ਯਤਨਾਂ ਦੀ ਲੋੜ ਹੈ